ਡੇਂਗੂ ਐਰੋਬਿਕਸ ਲਈ ਖਾਸ ਮੁਕਾਬਲੇ ਹੋਣ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਲੋ ਲੋਕਾਂ ਨੂੰ ਨਾ ਕੇਵਲ ਤੰਦਰੁਸਤ ਅਤੇ ਚੁਸਤ ਬਣਾਉਂਦੇ ਹਨ ਸਗੋਂ ਉਹਨਾਂ ਵਿੱਚ ਭੰਗੜੇ ਅਤੇ ਐਰੋਬਿਕਸ ਦੀਆਂ ਕੌਸ਼ਲਤਾ ਵੀ ਵਿਕਸਿਤ ਕਰਦੇ ਹਨ ਅਜਿਹੇ ਮੁਕਾਬਲੇ ਭਾਰਤ ਖਾਸ ਕਰਕੇ ਪੰਜਾਬ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਆਯੋਜਿਤ ਕੀਤੇ ਜਾਂਦੇ ਹਨ ਜਿੱਥੇ ਲੋਕ ਭੰਗੜੇ ਅਤੇ ਐਰੋਬਿਕਸ ਨੂੰ ਮਿਲਾ ਕੇ ਉੱਚ ਤੀਬਰਤਾ ਵਾਲੀ ਵਰਕਆਊਟ ਪੇਸ਼ ਕਰਦੇ ਹਨ ਇੰਡਵਿਜੁਅਲ ਭੰਗੜੇ ਇਹਨਾਂ ਮੁਕਾਬਲਿਆਂ ਵਿੱਚ ਹਰੇਕ ਵਿਅਕਤੀ ਆਪਣੀ ਖੁਦ ਦੀ ਪ੍ਰਦਰਸ਼ਨ ਦਿੰਦਾ ਹੈ ਇਹ ਮੁਕਾਬਲੇ ਆਮ ਤੌਰ 'ਤੇ ਫਿਟਨੈਸ ਤਕਨੀਕ ਲਚਕਤਾ ਅਤੇ ਸੈਟੈਮੀਨਾ ਅਧਾਰਿਤ ਹੁੰਦੇ ਹਨ ਇਹਨਾਂ ਮੁਕਾਬਲਿਆਂ ਵਿੱਚ ਚਾਰ ਤੋਂ ਦਸ ਲੋਕਾਂ ਦੀ ਟੀਮ ਹੁੰਦੀ ਹੈ ਜੋ ਸਥਾਈ ਰੀਅਲ ਟਾਈਮ ਕੋਰਿਓਗ੍ਰਾਫੀ ਦਿੰਦੀ ਹੈ ਕਿ ਇਹ ਸਮੂਹਿਕ ਕੋਆਰਡੀਨੇਸ਼ਨ ਸਮੇਂ ਦੇ ਪਾਬੰਦ ਰਹਿਣ ਅਤੇ ਭੰਗੜੇ ਦੇ ਤਰਕਾਂ 'ਤੇ ਅਧਾਰਤ ਹੁੰਦੇ ਹਨ ਇਹਨਾਂ ਵਿੱਚ ਕੁਝ ਵਿਸ਼ੇਸ਼ ਸੀਮਾ ਹੁੰਦੀਆਂ ਹਨ ਜਿਵੇਂ ਕਿ ਫਿਟਨੈਸ ਐਵਰਡ ਟਰਡੀਸ਼ਨਲ ਐਂਡ ਮਾਡਰਨ ਭੰਗੜਾ ਪਾਵਰ ਐਕਸਪ੍ਰੈਸ਼ਨ ਅਤੇ ਹਾਈ ਇੰਨਟੈਨਸਿਟੀ ਵਰਕਆਊਟ ਆਦਿ ਇਹਨਾਂ ਮੁਕਾਬਲਿਆਂ ਵਿੱਚ ਕੈਲਰੀ ਝਾੜਨ ਸਾੜਨ ਸਰੀਰ ਦੀ ਉਤਸਾਹਤਾ ਅਤੇ ਦਿਲ ਦੀ ਤੰਦਰੁਸਤੀ ਵਿੱਚ ਜਾਂਚ ਕੀਤੀ ਜਾਂਦੀ ਹੈ ਇਹ ਨੌਜਵਾਨਾਂ ਅਤੇ ਵਿਅਸਕਾਂ ਨੂੰ ਭੰਗੜੇ ਅਤੇ ਐਰੋਬਿਕਸ ਦੀ ਤਕਨੀਕ ਸਿੱਖਣ ਦਾ ਮੌਕਾ ਦਿੰਦੇ ਹਨ ਇਹ ਤੰਦਰੁਸਤੀ ਨੂੰ ਸੁਧਾਰਦੇ ਹਨ ਅਤੇ ਵਿਅਕਤੀਗਤ ਸ਼ਕਤੀ ਸਟੈਮਿਨਾ ਅਤੇ ਮਨੋਵਿਗਿਆਨਿਕ ਉਤਸਾਹ ਨੂੰ ਵਧਾਉਂਦੇ ਹਨ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਸਮੂਹਿਕ ਕੋਆਰਡੀਨੇਸ਼ਨ ਲੀਡਰਸ਼ਿਪ ਅਤੇ ਡਿਸਿਪਲਨ ਨੂੰ ਦੇ ਹੁਨਰ ਵਿਕਸਿਤ ਕਰਦੇ ਹਨ ਲੋਕਾਂ ਨੂੰ ਨਵੀਂ ਤਕਨੀਕਾਂ ਅਭਿਆਸ ਅਤੇ ਭੰਗੜੇ ਦੀ ਸਟਾਈਲ ਨਾਲ ਜਾਣੂ ਕਰਵਾਉਂਦੇ ਹਨ ਇਸ ਤਰੀਕੇ ਨਾਲ ਭੰਗੜਾ ਐਰੋਬਿਕਸ ਮੁਕਾਬਲੇ ਨਾ ਕੇਵਲ ਮਨਰੰਜਕ ਹੁੰਦੇ ਹਨ ਸਗੋਂ ਇਹ ਤੰਦਰੁਸਤੀ ਉਤਸਾਹ ਅਤੇ ਨਵੀਆਂ ਕੌਸ਼ਲਤਾ ਸਿੱਖਣ ਲਈ ਵੀ ਬਹੁਤ ਲਾਭਦਾਇਕ ਹੁੰਦੇ ਹਨ